ਇਹ ਸਵਾਲ ਮੇਰੇ ਲਈ ਬਹੁਤ ਹੀ ਵਧੀਆ ਆਇਆ ਹੈ ਕਿਉਂਕਿ ਮੈਂ ਇੱਕ ਖੁਦ ਟੇਲਰ ਹਾਂ ਮੈਂ ਤੁਹਾਨੂੰ ਆਪਣਾ ਅਨੁਭਵ ਸਾਂਝਾ ਕਰਨ ਜਾ ਰਹੀ ਹਾਂ ਇੱਕ ਮੇਰਾ ਰੈਗੂਲਰ ਕਸਟਮਰ ਹੈ ਜੋ ਕਿ ਮੇਰੇ ਤੋਂ ਕਾਫੀ ਚਿਰ ਤੋਂ ਸੂਟ ਸਵਾ ਰਿਹਾ ਹੈ ਉਹ ਟੀਚਿੰਗ ਦਾ ਕੰਮ ਕਰ ਰਹੇ ਹਨ ਉਹ ਉਹਨਾਂ ਨੇ ਮੈਨੂੰ ਇੱਕ ਕੱਪੜਾ ਲਿਆ ਕੇ ਦਿੱਤਾ ਜਿਹਦੇ ਵਿੱਚ ਇੱਕ ਡਿਫੈਕਟ ਸੀ ਉਹਨੇ ਕਿਹਾ ਵੀ ਮੈਂ ਫਰੋਕ ਬਣਵਾਉਣੀ ਹੈ ਅੰਬਰੇਲਾ ਨਾ ਕਿ ਉਹ ਫਰੋਕ ਬਣ ਸਕਦੀ ਸੀ ਪਰ ਉਹ ਮੈਨੂੰ ਕਹਿੰਦੀ ਨਹੀਂ ਮੈਂ ਬਣਾਉਣੀ ਵੀ ਫਰੋਕ ਹੈ ਇਸ ਕਰਕੇ ਮੈਂ ਉਸਨੂੰ ਬੜੇ ਹੀ ਤਜ਼ਰਬੇ ਨਾਲ ਕੱਟਿਆ ਵੀ ਬਹੁਤ ਸਾਰੀਆਂ ਉਹਨੂੰ ਮਤਲਬ ਔਖੇ ਤਰੀਕੇ ਨਾਲ ਉਹਨੂੰ ਸਾਂਝਾ ਕੀਤਾ ਮੈਂ ਉਹਨੂੰ ਬਸ ਕਿਵੇਂ ਵੀ ਕਹਿ ਲਓ ਬਸ ਮੈਂ ਉਹਨੂੰ ਬੜੇ ਔਖੇ ਤਰੀਕੇ ਨਾਲ ਉਹਨੂੰ ਕੱਟਿਆ ਪਰ ਜਦੋਂ ਬਣਾਈ ਉਹਨੂੰ ਡਿਜ਼ਾਈਨਿੰਗ ਕਰ ਕੁਰ ਕੇ ਤਾਂ ਫਰਾਕ ਐਡੀ ਬਣ ਕੇ ਕੰਪਲੀਟ ਹੋਈ ਕਿ ਉਹਨੂੰ ਸਾਰੀਆਂ ਟੀਚਰਾਂ ਨੇ ਸਲਾਹਿਆ ਬਹੁਤ ਸ ਪਸੰਦ ਕੀਤਾ ਇਸ ਕਰਕੇ ਆਹ ਕਸਟਮਰ ਨੇ ਮੈਨੂੰ ਹੋਰ ਵੀ ਕਸਟਮਰ ਲਗਵਾਏ